ਜੀ ਹਾਂ ਮੈਨੂੰ ਕੁਝ ਗੁਪਤ ਸਮੱਗਰੀ ਹੈ ਪਤਾ ਹੈ ਜੋ ਮੈਨੂੰ ਆਪਣੇ ਪਕਵਾਨਾਂ ਵਿੱਚ ਸ਼ਾਮਿਲ ਕਰਨੀ ਆਉਂਦੀ ਹੈ ਜਿਸ ਨਾਲ ਮੇਰੇ ਬਣਾਏ ਗਏ ਪਕਵਾਨਾਂ ਦਾ ਸਵਾਦ ਵੱਧ ਕੇ ਦੁਗਣਾ ਹੋ ਜਾਂਦਾ ਹੈ ਗੁਪਤ ਸਮੱਗਰੀ ਨੂੰ ਖਾਣੇ ਵਿੱਚ ਸ਼ਾਮਿਲ ਕਰਨਾ ਕੁਦਰਤੀ ਸਵਾਦ ਗਹਿਰਾਈ ਅਤੇ ਰਹੱਸ ਮਹਿਤਾ ਦਾ ਹੋਇਆ ਹੈ ਇਹ ਖਾਣਾ ਬਣਾਉਣ ਵਿੱਚ ਖਾਸ ਮਸਾਲੇ ਘਰ ਵਾਲੀ ਸਾਸ ਅਨੌਖੇ ਮਿਸ਼ਰਣ ਜਾਂ ਵਸਤੂਆਂ ਦੇ ਅਨੂਠੇ ਜੋੜਾਂ ਨੂੰ ਸ਼ਾਮਿਲ ਕਰਨਾ ਹੋਵੇਗਾ ਕੁਝ ਲੋਕ ਪਰਿਵਾਰੀ ਰਸੋਈ ਦੇ ਵਰਸੇ ਹੋਏ ਰਿਸ਼ਤੇ ਦੀਆਂ ਰੱਖੀਆਂ ਰੈਸਪੀਆਂ ਵਿੱਚ ਗੁਪਤ ਸਮੱਗਰੀ ਸ਼ਾਮਿਲ ਕਰਦੇ ਹਨ ਜਦੋਂ ਕਿ ਹੋਰ ਲੋਕ ਖੁਦ ਨੂੰ ਖਾਸ ਸਵਾਦ ਬਣਾਉਣ ਬਣਾਉਣ ਲਈ ਪਰਾਇਸ਼ਾਂ ਕਰਨਾ ਪਸੰਦ ਕਰਦੇ ਹਨ ਅਤੇ ਜਦੋਂ ਕੋਈ ਹੋਰ ਲੋਕ ਖੁਦ ਨੂੰ ਸਵਾਦ ਬਣਾਉਣ ਲਈ ਕਰ ਪਸੰਦ ਕਰਦੇ ਹਨ ਮੁੱਖ ਗੱਲ ਇਹ ਹੈ ਕਿ ਕਿ ਗੁਪਤ ਸਮੱਗਰੀ ਨੂੰ ਖਾਣਾ ਤਾਜ਼ਗੀ ਦੇਣ ਦੇ ਬਿਨਾਂ ਉਸ ਰੰਜਨ ਦਾ ਕਰਦਿਆਂ ਰੰਜਨ ਦਾ ਕਰਦਿਆਂ ਅਖਾੜੇ ਵਾਂਗ ਵਾਂਗ ਪ੍ਰਭਾਵਦਾਰ ਹੋਣਾ ਚਾਹੀਦਾ ਹੈ ਚਾਹੇ ਇਹ ਇੱਕ ਦਲਦਲ ਨਾਲ ਨਾਸ਼ਤਾ ਹੋ ਜਾਂ ਇੱਕ ਅਤੀਤ ਸਾਸ ਦਾ ਪਿੰਜ ਗੁਪਤ ਸਮੱਗਰੀ ਤੁਹਾਡੇ ਪਕਵਾਨ ਨੂੰ ਨਵੇਂ ਮੌਕਿਆਂ ਦੇ ਲਿਆਉਂਦੀ ਹੈ ਅਤੇ ਉਸਦਾ ਸਵਾਦ ਚੰਗਾ ਬਣਾਉਂਦੀ ਹੈ ਗੁਪਤ ਸਮੱਗਰੀ ਦੀ ਵਰਤੋਂ ਕਰਕੇ ਰਸੋਈ ਬਣਾਉਣਾ ਅਤੇ ਆਪਣੇ ਸੰਤੁਲਨ ਨੂੰ ਮੁਹੱਈਆ ਕਰ ਸਕਦਾ ਹੈ ਜਿਹੜੇ ਖਾਣੇ ਨੂੰ ਬੋਲਡ ਅਤੇ ਅਨੌਖੇ ਸਵਾਦ ਨਾਲ ਭਰਪੂਰ ਕੀਤਾ ਜਾ ਸਕਦਾ ਹੈ ਕੁਝ ਲੋਕ ਪਾਸ ਪਰਿਵਾਰਕ ਰਸੋਈ ਦੀ ਗੁਪਤ ਸਮੱਗਰੀ ਵਿੱਚ ਗੁਪਤ ਸਪਰਾਈਟਸ ਸਿਰਫ ਘਰ ਵਾਲੀ ਸਾਸ ਅਨੌਖੇ ਮਿਸਰਣ ਜਾਂ ਜੋੜਾ ਕਰਦੇ ਹਨ ਕੁਝ ਲੋਕ ਵਿਗ ਵਿਗਿਆਨਕ ਤਜ਼ਰਬਿਆਂ ਹੋਣ ਦੀ ਬਜਾਤ ਨਾਲ ਆਪਣੇ ਪ੍ਰਸ਼ਾਸਿਕ ਸਵਾਦ ਵਾਲੇ ਖਾਣੇ ਬਣਾਉਂਦੇ ਹਨ ਇਸ ਮੁਹੱਈਆ ਸਮੱਗਰੀ ਤੁਹਾਡੇ ਬਣਾਏ ਹੋਏ ਖਾਣੇ ਨੂੰ ਸਵਾਦ ਵਧਾ ਸਕਦੀ ਹੈ ਅਤੇ ਤੁਹਾਡੀ ਪ੍ਰਸ਼ਿਕਤ ਸਵਾਦ ਨੂੰ ਨਵੇਂ ਉਚਿਤ ਪਿਆਰ 'ਤੇ ਪਹੁੰਚਾ ਸਕਦੀ ਹੈ